ਜੀ ਮੈਂ ਆਪਣੀ ਗਤੀਵਿਧੀ ਨੂੰ ਟਰੈਕ ਕਰਨ ਅਤੇ ਸਿਹਤ ਦੀ ਨਿਗਰਾਨੀ ਕਰਨ ਲਈ ਫਿਟਨੈਸ ਟਰੈਕਰ ਅਤੇ ਸਮਾਰਟਵਾਚ ਦੀ ਵਰਤੋਂ ਕੀਤੀ ਹੈ ਇਹਦੀ ਬਹੁਤ ਸਾਰੀ ਵਿਸ਼ ਵਿਸ਼ੇਸ਼ਤਾਵਾਂ ਹਨ ਜੋ ਕਿ ਮੈਨੂੰ ਬਹੁਤ ਜ਼ਿਆਦਾ ਲਾਭ ਲਾਭਦਾਇਕ ਲੱਗਦੀਆਂ ਹਨ ਜਿਵੇਂ ਕਿ ਇਹ ਮੇਰੀ ਹਾਰਟਬੀਟ ਪਲਸ ਅਤੇ ਜਿੰਨੇ ਮੈਂ ਕਦਮ ਤੁਰੀ ਹਾਂ ਉਹਦੀ ਗਿਣਤੀ ਕਰ ਲੈਂਦਾ ਹੈ ਬਹੁਤ ਵਾਰ ਹੁੰਦਾ ਹੈ ਮੈਂ ਕੰਮ ਵਿੱਚ ਬਹੁਤ ਰੁੱਝ ਜਾਂਦੀ ਹਾਂ ਅਤੇ ਕੁਛ ਚੀਜ਼ਾਂ ਬਾਰੇ ਭੁੱਲ ਜਾਂਦੀ ਹਾਂ ਇਹ ਸਮਾਰਟਵਾਚ ਮੈਨੂੰ ਆਪ ਹੀ ਮੈਸੇਜ ਭੇਜ ਕੇ ਯਾਦ ਦਿਲਾ ਦਿੰਦਾ ਹੈ ਜਿਵੇਂ ਕਿ ਇਹ ਹਰ ਘੰਟੇ ਘੰਟੇ ਬਾਅਦ ਇਹ ਮੈਨੂੰ ਮੈਸੇਜ ਪਾ ਦਿੰਦਾ ਹੈ ਕਿ ਮੇਰੇ ਪਾਣੀ ਪੀਣ ਦਾ ਸਮਾਂ ਉਹ ਹੋ ਗਿਆ ਹੈ ਤਾਂ ਕਿ ਮੇਰਾ ਸਰੀਰ ਮੇਰੀ ਬਾਡੀ ਇੱਕਦਮ ਤਰੋ ਤਾਜ਼ਾ ਰਹੇ ਬਹੁਤ ਵਾਰ ਹੁੰਦਾ ਹੈ ਕਿ ਮੈਂ ਕਾਫ਼ੀ ਦੇਰ ਤੱਕ ਇੱਕ ਕੰਮ ਵਿੱਚ ਇੰਨਾ ਰੁੱਝ ਜਾਂਦੀ ਹਾਂ ਕਿ ਮੈਂ ਕਾਫ਼ੀ ਦੇਰ ਤੱਕ ਬੈਠੀ ਹੋਈ ਹੁੰਦੀ ਹਾਂ ਇਹ ਮੈਨੂੰ ਮੈਸੇਜ ਭੇਜ ਦਿੰਦਾ ਹੈ ਕਿ ਤੁਹਾਨੂੰ ਹੁਣ ਤੁਰਨਾ ਚਾਹੀਦਾ ਹੈ ਥੋੜ੍ਹੇ ਬਹੁਤ ਕਦਮ ਲੈ ਕੇ ਫਿਰ ਵਾਪਿਸ ਕੰਮ ਵਿੱਚ ਲੱਗ ਜਾਣਾ ਚਾਹੀਦਾ ਹੈ ਇਹ ਮੇਰੀ ਸਿਹਤ ਦਾ ਕਾਫ਼ੀ ਧਿਆਨ ਰੱਖਦਾ ਹੈ ਜਦੋਂ ਮੇਰੀ ਹਾਰਟਬੀਟ ਵੱਧ ਜਾਵੇ ਇਹ ਇੱਕ ਸਿਗਨਲ ਭੇਜ ਦਿੰਦਾ ਹੈ ਕਿ ਆਪਣਾ ਮੂਡ ਅਤੇ ਆਪਣੀ ਸਿਹਤ ਵੱਲ ਧਿਆਨ ਦਿਓ